ਮੈਂ ਇੱਕ ਮੁੱਖ ਘਟਨਾ ਤੁਹਾਡੇ ਸਾਹਮਣੇ ਪ੍ਰਸਤੁਤ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਸਾਡੇ ਇੱਧਰ ਪਿੰਡਾਂ ਵਿੱਚ ਹੜ੍ਹ ਆਇਆ ਸੀ ਜਿਸ ਕਾਰਨ ਸਾਡਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ ਜਿਸ ਕਾਰਨ ਉਹਨਾਂ ਦਾ ਕਾਫ਼ੀ ਸਮਾਨ ਖ਼ਰਾਬ ਹੋ ਗਿਆ ਇਸ ਹੜ੍ਹ ਨੇ ਸਾਡੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਸਾਡੇ ਪਿੰਡਾਂ ਦੇ ਬੰਨ੍ਹ ਵੀ ਟੁੱਟ ਗਏ ਸਨ ਅਤੇ ਕਈ ਖੇਤਾਂ ਵਿੱਚ ਫ਼ਸਲਾਂ ਵੀ ਖ਼ਰਾਬ ਹੋ ਗਈਆਂ ਸਨ ਅਤੇ ਕਈ ਪੁਲ ਵੀ ਟੁੱਟ ਗਏ ਸਨ ਅਤੇ ਸਕੂਲ ਲਿਆਉਣ ਲਈ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਲਈ ਬਹੁਤ ਜ਼ਿਆਦਾ ਸਾਨੂੰ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਇਸ ਹੜ੍ਹ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਹੈ ਇਸ ਕਰਕੇ ਇਹ ਘਟਨਾ ਸਾਨੂੰ ਹਮੇਸ਼ਾ ਹੀ ਯਾਦ ਰਹੇਗੀ ਇਹ ਘਟਨਾ ਦਾ ਉਲੇਖ ਅਸੀਂ ਹਰ ਇੱਕ ਪੱਧਰ 'ਤੇ ਨਹੀਂ ਜਦੋਂ ਕਿ ਯਾਰ ਦੋਸਤਾਂ ਵਿੱਚ ਬੈਠ ਕੇ ਵੀ ਕਰ ਸਕਦੇ ਹਾਂ ਇਹ ਘਟਨਾ ਸਾਨੂੰ ਹਮੇਸ਼ਾ ਹੀ ਦਰਸਾਉਂਦੀ ਰਹੇਗੀ ਬਸ ਇਸ ਘਟਨਾ ਦਾ ਜ਼ਿਕਰ ਅਸੀਂ ਤੁਹਾਡੇ ਸਾਹਮਣੇ ਕਰ ਰਹੇ ਹਾਂ ਇਹ ਸਭ ਤੋਂ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਘਟਨਾ ਸੀ ਇਸ ਘਟਨਾ ਨੂੰ ਸਾਡੇ ਨਾਲ਼ ਵਾਪਰਦੇ ਹੋਏ ਬਹੁਤ ਟਾਇਮ ਨਹੀਂ ਬਲਕਿ ਇੱਕ ਦੋ ਸਾਲ ਹੀ ਹੋਏ ਹਨ